ਨਮਸਕਾਰ ਮੇਰਾ ਨਾਮ ਸਾਕਸ਼ੀ ਹੈ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਅੱਜ ਕੱਲ੍ਹ ਇੱਕ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ ਕਿ ਵਿਦਿਆਰਥੀ ਸਕੂਲ ਨਹੀਂ ਜਾ ਪਾਉਂਦੇ ਉਸਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਿ ਉਹਨਾਂ ਦਾ ਸਕੂਲ ਘਰ ਤੋਂ ਕਾਫ਼ੀ ਦੂਰ ਹੈ ਅਤੇ ਜਾਂ ਫਿਰ ਕੋਈ ਆਵਾਜਾਈ ਦਾ ਸਾਧਨ ਨਹੀਂ ਹੈ ਅਤੇ ਉਹਨਾਂ ਨੂੰ ਜਾਣ ਲਈ ਜਾਂ ਫਿਰ ਉਹ ਕਈ ਵਿਦਿਆਰਥੀ ਕੰਮ ਕਿਤੇ ਹੋਰ ਕੰਮ ਕਰਦੇ ਹਨ ਜਾਂ ਫਿਰ ਕਈ ਵਿਦਿਆਰਥੀਆਂ ਨੂੰ ਘਰ ਵਿੱਚ ਮਦਦ ਕਰਨੀ ਪੈਂਦੀ ਹੈ ਜਾਂ ਕੋਈ ਪੈਸਿਆਂ ਦੀ ਕਮੀ ਕਾਰਣ ਨਹੀਂ ਸਕੂਲ ਜਾ ਪਾਉਂਦਾ ਜਾਂ ਕਈਆਂ ਨੂੰ ਜਾਗਰੂਕ ਨਹੀਂ ਕੀਤਾ ਜਾਂਦਾ ਸਕੂਲ ਬਾਰੇ ਜਾਂ ਮੌਸਮ ਖਰਾਬ ਹੋ ਜਾਂਦਾ ਹੈ ਅਤੇ ਜਾਂ ਫਿਰ ਕੋਈ ਬੁਦਿਆ ਬੁਨਿਆਦੀ ਢਾਂਚਾ ਖਰਾਬ ਹੁੰਦਾ ਹੈ ਇਸ ਲਈ ਇਹ ਸਾਰੇ ਕਾਰਣ ਹਨ ਕਿ ਵਿਦਿਆਰਥੀ ਸਕੂਲ ਨਹੀਂ ਜਾ ਪਾਉਂਦੇ ਇਹਨਾਂ ਵਿੱਚ ਇੱਕ ਕਾਰਣ ਤਾਂ ਇਹ ਹੈ ਕਿ ਦੂਰੀ ਕਈ ਵਿਦਿਆਰਥੀਆਂ ਦੀ ਸਕੂਲ ਅਤੇ ਘਰ ਵਿਚਕਾਰ ਦੂਰੀ ਬਹੁਤ ਹੈ ਜਿਹਰਾਂ ਨੂੰ ਮਤਲਬ ਉਹਨਾਂ ਨੂੰ ਸਕੂਲ ਆਉਣ ਲਈ ਕਾਫ਼ੀ ਜ਼ਿਆਦਾ ਦੂਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਕੂਲ ਆਉਂਦੇ ਹਨ ਤਾਂ ਉਹਨਾਂ ਨੂੰ ਸਵੇਰੇ ਕਾਫ਼ੀ ਜਲਦੀ ਘਰੋਂ ਨਿਕਲਣਾ ਪੈਂਦਾ ਹੈ ਅਤੇ ਜੇਕਰ ਉਹਨਾਂ ਨੂੰ ਛੁੱਟੀ ਹੁੰਦੀ ਹੈ ਤਾਂ ਉਹ ਕਾਫ਼ੀ ਲੇਟ ਪਹੁੰਚਦੇ ਹਨ ਜਿਨ੍ਹਾਂ ਨਾਲ ਉਹ ਰੋਜ਼ ਰੋਜ਼ ਸਕੂਲ ਨਹੀਂ ਆਉਂਦੇ ਇੱਕ ਤਾਂ ਦੂਰੀ ਇਸਦਾ ਕਾਰਣ ਹੈ ਅਤੇ ਦੂਸਰਾ ਕਈਆਂ ਕਈ ਵਿਦਿਆਰਥੀ ਜਿਹੜੇ ਹੈ ਉਹ ਪਿੰਡਾਂ ਵਿੱਚੋਂ ਆਉਂਦੇ ਹਨ ਜਿਨ੍ਹਾਂ ਦੇ ਉੱਥੇ ਆਵਾਜਾਈ ਦਾ ਕੋਈ ਵੀ ਸਾਧਨ ਨਹੀਂ ਹੈ ਕਈ ਆਵਾਜਾਈ ਦੇ ਸਾਧਨ ਕਾਰਣ ਸਕੂਲ ਨਹੀਂ ਆ ਪਾਉਂਦੇ ਅਤੇ ਕੁਝ ਵਿਦਿਆਰਥੀ ਅਜਿਹੇ ਹਨ ਜਿਹੜੇ ਆਪਣੇ ਸਕੂਲ ਦੀ ਫੀਸ ਭਰਨ ਲਈ ਆਪਣਾ ਬਾਹਰ ਕੰਮ ਕੋਈ ਨਾ ਕੋਈ ਕੰਮ ਕਰਦੇ ਹਨ ਕਿਸੇ ਦੀ ਜਾਂ ਫਿਰ ਕਿਸੇ ਦੁਕਾਨਾਂ ਵਗੈਰਾ 'ਤੇ ਲੱਗੇ ਹਨ ਤਾਂ ਉਹ ਵੀ ਵਿਦਿਆਰਥੀ ਰੋਜ਼ ਸਕੂਲ ਨਹੀਂ ਜਾ ਪਾਉਂਦੇ ਕੁਝ ਵਿਦਿਆਰਥੀ ਅਜਿਹੇ ਹਨ ਜਿਹਨਾਂ ਨੂੰ ਘਰ ਵਿੱਚ ਕੰਮ ਕਰਨਾ ਪੈਂਦਾ ਹੈ ਅਤੇ ਉਹ ਘਰ ਦੇ ਕੰਮ ਕਾਰਣ ਸਕੂਲ ਨਹੀਂ ਜਾ ਪਾਉਂਦੇ ਅਤੇ ਕੁਝ ਵਿਦਿਆਰਥੀ ਅਜਿਹੇ ਵੀ ਹਨ ਜਿਹੜੇ ਕਿ ਪੈਸਿਆਂ ਦੀ ਤੰਗੀ ਕਾਰਣ ਸਕੂਲ ਨਹੀਂ ਜਾ ਪਾਉਂਦੇ ਪਰ ਜਿਹੜੇ ਵਿਦਿਆਰਥੀ ਪੈਸਿਆਂ ਦੀ ਤੰਗੀ ਕਾਰਣ ਸਕੂਲ ਨਹੀਂ ਜਾ ਪਾਉਂਦੇ ਉਹਨਾਂ ਲਈ ਸਾਡੀ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੋਇਆ ਹੈ ਜੋ ਕਿ ਇਹ ਹੈ ਕਿ ਚੌਦਾਂ ਸਾਲ ਦੇ ਬੱਚੇ ਤੱਕ ਅੱਠਵੀਂ ਕਲਾਸ ਤੱਕ ਬੱਚੇ ਨੂੰ ਫਰੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਜਿਨ੍ਹਾਂ ਕੋਲ ਕੋਈ ਪੈਸਾ ਨਹੀਂ ਹੁੰਦਾ ਉਹ ਵਿਅਕਤੀ ਅੱਠਵੀਂ ਤੱਕ ਸ਼ਿਕਸ਼ਾ ਮੁਫ਼ਤ ਪ੍ਰਾਪਤ ਕਰ ਸਕਦੇ ਹਨ ਅਤੇ ਉਹਨਾਂ ਨੂੰ ਜ਼ਰੂਰ ਇਹ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਸਕੂਲ ਨਾ ਜਾਣ ਦਾ ਇਹ ਕੋਈ ਕਾਰਣ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਪੈਸਿਆਂ ਦੀ ਤੰਗੀ ਇੱਕ ਕਾਰਣ ਨਹੀਂ ਹੈ ਸਰਕਾਰ ਨੇ ਇਹਨਾਂ ਨੂੰ ਫਰੀ ਸ਼ਿਕਸ਼ਾ ਵੀ ਦਿੱਤੀ ਹੋਈ ਹੈ ਕਈ ਵਿਦਿਆਰਥੀ ਜਿਹੜੇ ਹੈ ਉਹ ਪੜ੍ਹਾਈ ਲਈ ਜਾ ਜਾਗਰੂਕ ਹੈ ਨਹੀਂ ਕਈ ਸੋਚਦੇ ਹੈ ਕਈਆਂ ਦੇ ਮਾਪੇ ਸੋਚਦੇ ਹਨ ਕਿ ਸਾਡੇ ਵਿਦਿਆਰਥੀਆਂ ਨੂੰ ਅਸੀਂ ਕ ਪੜ੍ਹਾਵਾਂਗੇ ਨਹੀਂ ਉਹਨਾਂ ਨੂੰ ਅਸੀਂ ਆਪਣੇ ਘਰ ਵਿੱਚ ਹੀ ਅਪਣਾ ਹੀ ਬਿਜਨਸ ਦਾ ਹੀ ਕੰਮ ਕਰਾਵਾਂਗੇ ਤਾਂ ਉਹਨਾਂ ਦੀ ਸੋਚ ਗਲਤ ਆ ਹਰ ਇੱਕ ਨੂੰ ਪੜ੍ਹਾਈ ਵਿੱਚ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਹਰ ਬੱਚੇ ਨੂੰ ਦਸਵੀਂ ਤੱਕ ਤਾਂ ਜ਼ਰੂਰ ਪੜ੍ਹਨਾ ਚਾਹੀਦਾ ਹੈ ਕਈ ਵਾਰ ਤਾਂ ਮੌਸਮ ਅਜਿਹਾ ਹੋ ਜਾਂਦਾ ਹੈ ਕਿ ਬੱਚਿਆਂ ਨੂੰ ਸਕੂਲ ਜਾਣ ਵਿੱਚ ਤੰਗੀ ਮੌਸਮ ਕਾਰਣ ਆ ਜਾਂਦੀ ਹੈ ਜਿੱਦਾਂ ਕਿ ਕਦੇ ਬਾਰਿਸ਼ ਹੁੰਦੀ ਆ ਕਈ ਜਦੋਂ ਬਰਸਾਤ ਦਾ ਮੌਸਮ ਆਉਂਦਾ ਤਾਂ ਸਾਨੂੰ ਸਕੂਲ ਵੀ ਬੰਦ ਕਰਨੇ ਪੈਂਦੇ ਹਨ ਕਿਉਂਕਿ ਮੌਸਮ ਇੰਨਾ ਖਰਾਬ ਹੁੰਦਾ ਕਿ ਬਾੜ੍ਹ ਦੀ ਸਥਿਤੀ ਵੀ ਬਣ ਜਾਂਦੀ ਹੈ ਅਤੇ ਅਗਰ ਬੱਚੇ ਸਕੂਲ ਜਾਂਦੇ ਹਨ ਤਾਂ ਉਹ ਕਾਫ਼ੀ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਕਈ ਵਾਰ ਜ਼ਿਆਦਾ ਗਰਮੀ ਅਤੇ ਜ਼ਿਆਦਾ ਸਰਦੀ ਕਾਰਣ ਵੀ ਸਕੂਲ ਜਿਹੜੇ ਆ ਉਹ ਬੰਦ ਕਰਨੇ ਪੈਂਦੇ ਆ ਇਸ ਲਈ ਸਕੂਲ ਵਿਦਿਆਰਥੀਆਂ ਦੇ ਸਕੂਲ ਘੱਟ ਜਾਣ ਦਾ ਕਾਰਣ ਮੌਸਮ ਵੀ ਹੋ ਸਕਦਾ ਹੈ ਕਈ ਵਾਰ ਸਾਡੇ ਸਕੂਲ ਦਾ ਬੁਨਿਆਦੀ ਢਾਂਚਾ ਠੀਕ ਨਹੀਂ ਹੁੰਦਾ ਜਿਸ ਕਾਰਨ ਵੀ ਬੱਚੇ ਜਿਹੜੇ ਆ ਉਹ ਸਕੂਲ ਨਹੀਂ ਜਾ ਪਾਉਂਦੇ ਹਨ ਇਸ ਲਈ ਅਸੀਂ ਦੇਖਦੇ ਹਾਂ ਕਿ ਕਾਫ਼ੀ ਜ਼ਿਆਦਾ ਕਾਰਣ ਹਨ ਜਿਨ੍ਹਾਂ ਕਾਰਣ ਵਿਦਿਆਰਥੀ ਜਿਹੜੇ ਹੈ ਉਹ ਸਕੂਲ ਨਹੀਂ ਜਾ ਪਾਉਂਦੇ ਇਹਨਾਂ ਸਾਰੇ ਕਾਰਣਾ ਨੂੰ ਸਾਨੂੰ ਸੁਧਾਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਰੋਜ਼ ਸਕੂਲ ਜਾਣ ਅਤੇ ਉਹ ਇੱਕ ਸ਼ਿਕਸ਼ਿਤ ਨਾਗਰਿਕ ਬਣ ਸਕਣ ਧੰਨਵਾਦ